ਬਹੁਤ ਵਧੀਆ ਕੌਅਸ਼ਚਨ ਕੀਤਾ ਸਰ ਤੁਸੀਂ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਜਿੱਦਾਂ ਸਾਡਾ ਪੁਰਾਣਾ ਪੰਜਾਬ ਅਸੀਂ ਕਹਿੰਦੇ ਸੀ ਸੋਨੇ ਦੀ ਚਿੜੀਆ ਮੈਂ ਇਹੀ ਚਾਹੁੰਦਾ ਅੱਜ ਦਾ ਪੰਜਾਬ ਜੋ ਨਸ਼ੇ ਦੇ ਵਿੱਚ ਗੁੱਝਿਆ ਹੋਇਆ ਹੈ ਉਹਨੂੰ ਨਸ਼ਾ ਮੁਕਤ ਕਰਾਂ ਖੇਡਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਾਂ ਇਹੋ ਜਿਹਾ ਪੰਜਾਬ ਬਣਾਉਣਾ ਜਿਹੜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੇ ਟਾਇਮ ਦਾ ਪੰਜਾ ਪੰਜਾਬ ਸੀਗਾ ਦੁਬਾਰਾ ਫਿਰ ਇਹਨੂੰ ਮੈਂ ਸੋਨੇ ਦੀ ਚਿੜੀਆ ਬਣਾ ਸਕਾਂ